ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਭਾਅ ਜੀ ਮੇਰੀ ਗੱਲ ਲਖਵਿੰਦਰ ਸਿੰਘ ਜੀ ਨਾਲ ਹੋ ਰਹੀ ਆ ਹਾਂਜੀ ਹਾਂਜੀ ਭਾਅ ਜੀ ਕੱਲ੍ਹ ਤੁਸੀਂ ਮੈਨੂੰ ਲੁਧਿਆਣੇ ਤੋਂ ਅੰਮ੍ਰਿਤਸਰ ਛੱਡਿਆ ਸੀ ਨਾ ਹਾਂਜੀ ਭਾਅ ਜੀ ਗੁਰਪ੍ਰੀਤ ਕੌਰ ਹਾਂਜੀ ਹਾਂਜੀ ਹਾਂਜੀ ਭਾਅ ਜੀ ਭਾਅ ਜੀ ਮੈਨੂੰ ਕੱਲ੍ਹ ਤੁਹਾਡੇ ਨਾਲ ਮਤਲਬ ਕਿ ਸਫ਼ਰ ਕਰਨਾ ਬੜਾ ਵਧੀਆ ਲੱਗਿਆ ਮੇਰੇ ਬੱਚਿਆਂ ਨੂੰ ਵੀ ਬਹੁਤ ਵਧੀਆ ਲੱਗਿਆ ਹਾਂਜੀ ਮੈਂ ਬਹੁਤ ਵਧੀਆ ਮਤਲਬ ਕਿ ਮੇਰੇ ਬੱਚਿਆਂ ਨੂੰ ਵੀ ਲੱਗਿਆ ਤਾਤੇ ਤੁਹਾਡੇ ਨਾਲ ਆਉਣਾ ਮੈਨੂੰ ਇੱਥੇ ਅੰਮ੍ਰਿਤਸਰ ਹਾਂਜੀ ਭਾਅ ਜੀ ਹਾਂਜੀ ਭਾਅ ਜੀ ਬਾਕੀ ਬੱਸ ਵਾਲੇ ਭਾਅ ਜੀ ਕਰਾਇਆ ਹੀ ਬੜਾ ਮੰਗਦੇ ਪਏ ਸੀ ਮੈਂ ਇੱਕ ਦੋ ਜਣਿਆਂ ਨਾਲ ਹੋਰ ਵੀ ਡਰਾਈਵਰਾਂ ਨਾਲ ਗੱਲ ਕੀਤੀ ਲੇਕਿਨ ਮੈਨੂੰ ਉਹਨਾਂ ਦਾ ਵਿਵਹਾਰ ਨਹੀਂ ਚੰਗਾ ਲੱਗਿਆ ਹਾਂਜੀ ਹਾਂਜੀ ਨਹੀਂ ਨਹੀਂ ਭਾਅ ਜੀ ਮੈਨੂੰ ਬਹੁਤ ਵਧੀਆ ਲੱਗਿਆ ਤੁਸੀਂ ਸ ਮੇਰੇ ਬੱਚਿਆਂ ਨੂੰ ਵੀ ਬਹੁਤ ਖੁਸ਼ ਕੀਤਾ ਰਾਹ ਵਿੱਚ ਮਨਮੋਹਿਤ ਉਹਨਾਂ ਨੂੰ ਵਿਖਾਈਆਂ ਜਗ੍ਹਾਵਾਂ ਹਾਂਜੀ ਹਾਂਜੀ ਹਾਂਜੀ ਭਾਅ ਜੀ ਨਹੀਂ ਨਹੀਂ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਮੈਂ ਅਤੇ ਅਸੀਂ ਜਿਵੇਂ ਮਤਲਬ ਕਿ ਇਕੱਲੇ ਸੀ ਮੇਰੇ ਨਾਲ ਮੇਰੇ ਬੱਚੇ ਵੀ ਸੀ ਦੋ ਮੈਨੂੰ ਡਰ ਵੀ ਲੱਗ ਰਿਹਾ ਸੀ ਕਿ ਇੰਨਾ ਰਾਤ ਦਾ ਸਮਾਂ ਹੈ ਮੈਂ ਕਿੱਦਾਂ ਸਫ਼ਰ ਕਰ ਪਾਵਾਂਗੀ ਬੱਚਿਆਂ ਨਾਲ ਪਰ ਤੁਸੀਂ ਸਾਨੂੰ ਜਿਵੇਂ ਕਹਿੰਦੇ ਨਾ ਇੱਕ ਰੱਬ ਦਾ ਘਲਾਇਆ ਹੀ ਬੰਦਾ ਜਿਵੇਂ ਹਾਂਜੀ ਹਾਂਜੀ ਹਾਂਜੀ ਭਾਅ ਜੀ ਹਾਂਜੀ ਹਾਂਜੀ ਮੈਂ ਰਾਤ ਟਾਈਮ ਤੁਹਾਡਾ ਤਾਂ ਨਹੀਂ ਸ਼ੁਕਰੀਆ ਅਦਾ ਕਰ ਸਕੀ ਕਿਉਂਕਿ ਰਾਤ ਨੂੰ ਹਨੇਰਾ ਵੀ ਕਾਫ਼ੀ ਹੋ ਚੁੱਕਾ ਸੀ ਹਾਂਜੀ ਅਤੇ ਮੈਂ ਫਟਾਫਟ ਮੇਰੇ ਬੱਚੇ ਵੀ ਸੋ ਗਏ ਸੀ ਤਾਂ ਮੈਂ ਕਿਹਾ ਇਹਨਾਂ ਨੂੰ ਅੰਦਰ ਜਾ ਕੇ ਮੈਂ ਫਟਾਫਟ ਬੈਡ 'ਤੇ ਲਟਾ ਦਾ ਹਾਂਜੀ ਬੱਚਿਆਂ ਨੂੰ ਵੀ ਬਹੁਤ ਵਧੀਆ ਲੱਗਾ ਮੈਂ ਜਸਟ ਹੁਣੇ ਹੀ ਘਰ ਦਾ ਕੰਮ ਕਰਕੇ ਵਿਹਲੀ ਹੋਈ ਸੀ ਅਤੇ ਮੈਨੂੰ ਮੇਰੇ ਦਿਲ 'ਚ ਸੀ ਕਿ ਮੈਂ ਰਾਤ ਵੀ ਤੁਹਾਡਾ ਸ਼ੁਕਰੀਆ ਅਦਾ ਨਹੀਂ ਕਰ ਸਕੀ ਤਾਂ ਮੈਂ ਹੁਣ ਤੁਹਾਡਾ ਸ਼ੁਕਰੀਆ ਅਦਾ ਕਰ ਸਕਾਂ ਹਾਂਜੀ ਮੈਂ ਧੰਨਵਾਦ ਕਰਦੀ ਤੁਹਾਡਾ ਦਿਲੋਂ ਧੰਨਵਾਦ ਕਰਦੀ ਹਾਂ ਮੈਂ ਤੁਹਾਡੀ ਕੰਪਨੀ ਨੂੰ ਵੀ ਫੋਨ ਕਰਕੇ ਤੁਹਾਡੇ ਬਾਰੇ ਬਹੁਤ ਵਧੀਆ ਦੱਸਾਂਗੀ ਕਿ ਤੁਹਾਡੀ ਤਨਖਾਹ ਵਧਾਈ ਜਾਵੇ ਹਾਂਜੀ ਹਾਂਜੀ ਬਾਕੀ ਤੁਸੀਂ ਮੈਨੂੰ ਭਾਅ ਜੀ ਆਪਣਾ ਪੇ ਟੀ ਐੱਮ ਸੈਂਡ ਕਰ ਦਿਓ ਮੈਂ ਤੁਹਾਡੇ ਬਾਕੀ ਦੇ ਪੈਸੇ ਵੀ ਤੁਹਾਨੂੰ ਭੇਜਣਾ ਚਾਹੁੰਦੀ ਹਾਂ ਹਾਂਜੀ ਨਹੀਂ ਨਹੀਂ ਜੋ ਤੁਹਾਡਾ ਹੱਕ ਹੈ ਉਹ ਤਾਂ ਮੈਂ ਤੁਹਾਨੂੰ ਦੇਵਾਂਗੀ ਦੇਵਾਂਗੀ ਬਾਕੀ ਮੈਨੂੰ ਬਹੁਤ ਵਧੀਆ ਲੱਗਿਆ ਅਗਾਂਹ ਵੀ ਜਦੋਂ ਅਸੀਂ ਕਿਤੇ ਜਾਣਾ ਹੋਵੇਗਾ ਨਾ ਮੈਂ ਤੁਹਾਡੇ ਨਾਲ ਹੀ ਜਾਣਾ ਮਤਲਬ ਕਿ ਤੁਹਾਡੀ ਗੱਡੀ 'ਤੇ ਜਾਣਾ ਪਸੰਦ ਕਰਾਂਗੀ ਹਾਂਜੀ ਭਾਅ ਜੀ ਹਾਂਜੀ ਮੈਂ ਆਪਣੇ ਘਰ ਵਾਲੇ ਨੂੰ ਵੀ ਤੁਹਾਡੇ ਬਾਰੇ ਦੱਸਿਆ ਉਹਨਾਂ ਨੇ ਵੀ ਮੈਨੂੰ ਇਹ ਹੀ ਕਿਹਾ ਕਿ ਨਹੀਂ ਭਾਅ ਜੀ ਦਾ ਧੰਨਵਾਦ ਕਰਨਾ ਬਣਦਾ ਹੈ ਹਾਂਜੀ ਜੀ ਬਾਕੀ ਤੁਸੀਂ ਭਾਅ ਜੀ ਮੈਨੂੰ ਆਪਣਾ ਪੇ ਟੀ ਐੱਮ ਸੈਂਡ ਕਰ ਦੇਣਾ ਮੈਂ ਤੁਹਾਨੂੰ ਤੁਹਾਡੀ ਬਾਕੀ ਪੈਸੇ ਵੀ ਕਰ ਦਾਂਗੀ ਹਾਂਜੀ ਹਾਂਜੀ ਓਕੇ ਧੰਨਵਾਦ ਭਾਅ ਜੀ